ਮੀਡੀਆ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਮੀਡੀਆ ਵਾਲੇ ਰੇਡੀਓ ਟੈਲੀਵਿਜ਼ਨ ਰਾਹੀਂ ਖ਼ਬਰਾਂ ਦਿੰਦੇ ਹਨ ਸਾਡੇ ਪਿੰਡਾਂ ਵਿੱਚ ਬਜ਼ੁਰਗ ਅਤੇ ਅਨਪੜ੍ਹ ਲੋਕ ਪੰਜਾਬੀ ਵਿੱਚ ਹੀ ਖ਼ਬਰਾਂ ਸੁਣਦੇ ਹਨ ਅਨਪੜ੍ਹਾਂ ਲਈ ਮੀਡੀਆ ਵਾਲੇ ਵਾਲੇ ਚੈਨਲ ਪੰਜਾਬੀ ਚੈਨਲ ਪੰਜਾਬੀ ਵਿੱਚ ਦੇਸ਼ ਭਰ ਦੀਆਂ ਖ਼ਬਰਾਂ ਸੁਣਦੇ ਹਨ ਅਤੇ ਸੁਣਾਉਂਦੇ ਹਨ ਤਾਂ ਕਿ ਅਨਪੜ੍ਹ ਲੋਕ ਨੂੰ ਦੇਸ਼ ਭਰ ਦੀਆਂ ਖਬਰਾਂ ਪਤਾ ਚੱਲਦੀਆਂ ਰਹਿਣ ਕਈ ਕੀ ਦੇਸ਼ ਵਿੱਚ ਕੀ ਚੱਲ ਰਿਹਾ ਹੈ ਇਹ ਪੰਜਾਬੀ ਭਾਸ਼ਾ ਰੇਡੀਓ ਟੈਲੀਵਿਜ਼ਨ ਰਾਹੀਂ ਵਰਤੀ ਜਾਂਦੀ ਹੈ ਜਿਵੇਂ ਬਜ਼ੁਰਗ ਲੋਕ ਰੇਡੀਓ 'ਤੇ ਪੰਜਾਬੀ ਗੀਤ ਸੁਣਦੇ ਹਨ ਅਤੇ ਖ਼ਬਰਾਂ ਸੁਣਦੇ ਹਨ ਅਨਪੜ੍ਹ ਔਰਤਾਂ ਟੈਲੀਵਿਜ਼ਨ 'ਤੇ ਪੰਜਾਬੀ ਨਾਟਕ ਗੀਤ ਅਤੇ ਹੋਰ ਕੁਝ ਦੇਖਦੀਆਂ ਹਨ ਦੇਖਦੀਆਂ ਰਹਿੰਦੀਆਂ ਹਨ ਪ੍ਰਿੰਟ ਦੇ ਵਿੱਚ ਵੀ ਪੰਜਾਬੀ ਭਾਸ਼ਾ ਵਰਤੀ ਜਾਂਦੀ ਹੈ ਤਾਂ ਕਿ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਪੰਜਾਬੀ ਸਾਡੀ ਮਾਂ ਭਾਸ਼ਾ ਹੈ ਮਾਂ ਬੋਲੀ ਹੈ ਸਾਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਬੋਲਣੀ ਚਾਹੀਦੀ ਹੈ ਸਾਨੂੰ ਹਰ ਵਕਤ ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਇਹ ਜਿਹੜੇ ਜਿਹਨਾਂ ਨੂੰ ਨਹੀਂ ਸਮਝ ਆਉਂਦੀ ਅਨਪੜ੍ਹ ਲੋਕਾਂ ਨੂੰ ਵਧੀਆ ਤਰੀਕੇ ਨਾਲ ਸਮਝ ਆਵੇ